ਮੈਂ ਜਦੋਂ ਬਚਪਨ ਵਿੱਚ ਨਗਰ ਕੀਰਤਨਾਂ ਨੂੰ ਆਪਣੇ ਪਿਤਾ ਜੀ ਅਤੇ ਮਾਤਾ ਜੀ ਨਾਲ ਜਾਂਦਾ ਹੁੰਦਾ ਸੀ ਉਦੋਂ ਤੋਂ ਹੀ ਮੈਨੂੰ ਗਤਕਾ ਦੇਖਣਾ ਬਹੁਤ ਪਸੰਦ ਸੀ ਸਾਡੇ ਇੱਥੇ ਨਗਰ ਕੀਰਤਨਾਂ ਨੂੰ ਗਤਕਾਂ ਦੇ ਵੱਡੇ ਵੱਡੇ ਅਖਾੜੇ ਆ ਕੇ ਆਪਣੇ ਜੋਹਰ ਦਿਖਾਉਂਦੇ ਹਨ ਉਹਨਾਂ ਨੂੰ ਵੇਖ ਵੇਖ ਕੇ ਜਿਉਂ ਜਿਉਂ ਮੈਂ ਵੱਡਾ ਹੁੰਦਾ ਗਿਆ ਤਾਂ ਮੇਰੀ ਵੀ ਗਤਕਾ ਵੱਲ ਰੁਚੀ ਵਧਗੀ ਵਧਦੀ ਗਈ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਆਪਣੀ ਨੌਵੀਂ ਕਲਾਸ ਤੋਂ ਬਾਅਦ ਗਤਕਾ ਦੇ ਅਖਾੜੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਉੱਥੇ ਗਤਕਾ ਸਿੱਖਦੇ ਸਿੱਖਦੇ ਮੈਂ ਵੀ ਹੌਲੀ ਹੌਲੀ ਨਿਪੁੰਨ ਹੋ ਗਿਆ ਗਤਕਾ ਸ਼ਾਸਤਰ ਵਿੱਦਿਆ ਦੇ ਖਜ਼ਾਨੇ ਨੂੰ ਬਾਬਾ ਬੁੱਢਾ ਜੀ ਨੇ ਸੰਭਾਲਿਆ ਸੀ ਤੀਜੇ ਗੁਰੂ ਅਮਰਦਾਸ ਜੀ ਨੇ ਧਿਆਨ ਸਿਮਰਨ ਨੂੰ ਮੁੱਖ ਰੱਖਿਆ ਅਤੇ ਮੱਲ ਅਖਾੜੇ ਦੀ ਵਿਰਾਸਤ ਨੂੰ ਸੰਭਾਲਿਆ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਬਚਪਨ ਤੋਂ ਹੀ ਬਾਬਾ ਬੁੱਢਾ ਜੀ ਪਾਸੋਂ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ ਉਸ ਸਮੇਂ ਦੇ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕਰਨ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਗਤਕਾ ਸਿਖਲਾਈ ਦਿੱਤੀ ਜਾਨ ਦੇਣ ਲਈ ਇੱਕ ਅਖਾੜਾ ਖੋਲ੍ਹਿਆ ਮੁਕਾਬਲੇ ਵੀ ਕਰਾਣੇ ਕਰਾਏ ਕਰਾਉਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਘੋੜ ਸਵਾਰੀ ਦੇ ਨਾਲ ਨਾਲ ਬਹੁਤ ਅਹੁਦਿਆਂ ਦੀ ਨਿਯੁਕਤੀ ਲਈ ਗਤਕੇ ਬਾਜਾਂ ਨੂੰ ਪਹਿਲ ਦਿੱਤੀ ਜਾਂਦੀ ਸੀ ਕਈ ਘਰਾਣਿਆਂ ਵਿੱਚ ਤਾਂ ਬਹੁਤ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਗਤਕਾ ਖੇਡਣ ਦੀ ਜਾਂਚ ਸਿਖਾਈ ਜਾਂਦੀ ਮੈਨੂੰ ਵੀ ਗਤਕਾ ਮੇਰੇ ਪਿਤਾ ਜੀ ਨੇ ਸਿਖਵਾਈਆਂ ਇਹ ਆਤਮਕ ਰਸ਼ਤਾ ਰਕਸ਼ਾ ਲਈ ਕੰਮ ਆਉਂਦੀਆਂ ਹਨ ਇਸ ਦੀ ਵਰਦੀ ਦਾ ਵੀ ਇੱਕ ਆਪਣਾ ਹੀ ਅਨਿਖੜਵਾਂ ਅੰਗ ਹੈ ਕਮਰ ਕੱਸਾ ਹੁੰਦਾ ਹੈ ਜਿਸ ਵਿੱਚ ਸਾਨੂੰ ਭਾਰ ਚੱਕਣ ਲਈ ਕੋਈ ਔਖੀ ਨਹੀਂ ਹੁੰਦੀ ਆਤਮਕ ਰਕਸ਼ਾ ਲਈ ਹਰੇਕ ਪੰਜਾਬੀ ਗੱਭਰੂ ਨੂੰ ਗਤਕਾ ਸਿੱਖਣੀਆਂ ਚਾਹੀਦੀਆਂ ਹਨ ਗਤਕਾ ਮਨੁੱਖੀ ਜੀਵਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਦੁਸ਼ਮਣ ਦੇ ਵਾਰ ਦਾ ਪਤਾ ਲੱਗਦਾ ਹੈ ਗੁਰੂ ਨਾਨਕ ਦੇਵ ਜੀ ਦੇ ਟੈਮ ਤੋਂ ਹੀ ਸਿੱਖ ਯੋਧੇ ਗਤਕਾ ਵਿੱਚ ਆਪਣੇ ਜੋਹਰ ਦਿਖਾਉਂਦੇ ਆ ਰਹੇ ਹਨ ਗਤਕਾ ਸਿੱਖਾਂ ਦੀ ਜੰਗੀ ਕਲਾ ਹੈ ਜਿਸ ਵਿੱਚ ਜੰਗਬਾਦੀ ਅਤੇ ਦੁਸ਼ਮਣਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ ਇਸ ਦੀ ਸਿਖਲਾਈ ਕਈ ਵੀ ਔਰਤ ਜਾਂ ਮਰਦ ਲੈ ਸਕਦਾ ਹੈ ਖਾਸ ਤੌਰ ਕੇ ਅੱਜ ਦੇ ਜ਼ਮਾਨੇ ਵਿੱਚ ਔਰਤਾਂ ਨੂੰ ਗਤਕਾ ਦੀ ਸਿਖਲਾਈ ਲੈਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਰਕਸ਼ਾ ਆਤਮ ਰਕਸ਼ਾ ਕਰ ਸਕਣ ਨਿਹੰਗ ਸਿੰਘ ਇਸ ਕਲਾ ਦੇ ਮਾਹਰ ਹੁੰਦੇ ਆ ਅਣਗਿਣਤ ਕਲਾਵਾਂ ਵਿੱਚੋਂ ਇੱਕ ਕਲਾ ਏ ਸ਼ਸਤਰ ਵਿੱਦਿਆ ਸ਼ਸਤਰ ਕਲਾ ਸ਼ਸਤਰ ਕਲਾ ਹਰੇਕ ਨੂੰ ਲੈਣੀ ਚਾਹੀਦੀ ਹੈ ਇਹਨਾਂ ਸ਼ੈਲੀਆਂ ਵਿੱਚੋਂ ਹੀ ਇੱਕ ਸ਼ੈਲੀ ਗਤਕਾ ਜੋ ਵਧੇਰੇ ਕਰਕੇ ਪੰਜਾਬ ਵਿੱਚ ਖੇਡੀ ਜਾਂਦੀ ਹੈ